ਹਾਂਜੀ ਮੈਂ ਹੁਣ ਆਪਣਾ ਆਰਡਰ ਮੋਮੋਜ਼ ਦਾ ਜਿਹੜਾ ਆਰਡਰ ਕੀਤਾ ਸੀ ਉਹਨੂੰ ਕੈਂਸਲ ਕਰਨ ਲਈ ਮੈਂ ਫੋਨ ਕੀਤਾ ਹੈ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਮੇਰਾ ਮੋਮੋਸ ਦਾ ਆਡਰ ਸੀ ਉਹਨੂੰ ਕੈਂਸਲ ਕਰ ਦਿਓ ਅਤੇ ਉਹਦੀ ਥਾਂ 'ਤੇ ਜਿਹੜਾ ਮੈਂ ਪਹਿਲਾਂ ਔਡਰਸ ਸੋਇਆ ਚਾਪ ਮੰਗਵਾਈ ਹੋਈ ਸੀ ਉਹਨੂੰ ਤੁਸੀਂ ਰੱਖ ਲਓ ਅਤੇ ਉਹ ਮੈਨੂੰ ਭੇਜ ਵਾ ਦਿਓ ਕਿਉਂਕਿ ਮੈਂ ਸੋਇਆ ਚਾਮ ਜਿਹੜੀ ਹੈ ਉਹ ਸਾਡੀ ਸਾਡੀ ਰੋਟੀ ਨਾਲ ਵੀ ਖਾਧੀ ਜਾ ਸਕਦੀ ਹੈ ਹੈ ਨਾ ਅਤੇ ਬਟ ਜਿਹੜੇ ਮੋਮੋਜ਼ ਆ ਉਹ ਅਸੀਂ ਰੋਟੀ ਨਾਲ ਨਹੀਂ ਖਾ ਸਕਦੇ ਅਤੇ ਨਾਲ ਮੋਮੋਜ਼ ਵਿੱਚ ਜਿਹੜਾ ਆ ਉਹ ਮੈਦਾ ਕਾਫੀ ਜ਼ਿਆਦਾ ਹੁੰਦਾ ਜਿਹੜੇ ਕਿ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਆ ਇਸ ਕਰਕੇ ਉਹਦੇ ਨਾਲ ਜਿਹੜੀਆਂ ਚਟਣੀਆਂ ਮਿਲਦੀਆਂ ਜਿਹੜੀਆਂ ਰੈਡ ਸੋਸ ਹੁੰਦੀ ਆ ਉਹ ਬੜੀ ਮਿਰਚਾਂ ਵਾਲੀ ਹੁੰਦੀ ਹੈ ਜਿਹੜੀ ਕਿ ਸਾਨੂੰ ਬੜਾ ਨੁਕਸਾਨ ਪਹੁੰਚਾਉਂਦੀ ਹੈ ਸਾਡੀ ਸਿਹਤ ਨੂੰ ਇਸ ਕਰਕੇ ਮੈਂ ਤੁਹਾਨੂੰ ਕਹਿੰਦੀ ਹਾਂ ਵੀ ਸੋਇਆ ਚਾਪ ਦਾ ਔਡਰ ਜਿਹੜਾ ਮੇਰਾ ਉਹਨੂੰ ਤੁਸੀਂ ਮੇਰਾ ਔਡਰ ਭੇਜ ਵਾ ਦਿਓ ਅਤੇ ਜਿਹੜਾ ਮੇਰਾ ਮੋਮੋਜ਼ ਦਾ ਔਡਰ ਆ ਉਹ ਤੁਸੀਂ ਮੇਰਾ ਕੈਂਸਲ ਕਰ ਦਿਓ